ਮੇਰਾ ਨਾਮ ਅਰਵਿੰਦ ਹੈਗਾ ਅਤੇ ਮੈਂ ਪਠਾਨਕੋਟ ਤੋਂ ਰਹਿਣ ਵਾਲਾ ਹੈਗਾ ਅਤੇ ਜਿਹੜੀ ਮੈਨੂੰ ਆਰਮੀ ਦਾ ਬੜਾ ਹੀ ਸ਼ੌਂਕ ਹੈ ਜਿਸ ਕਰਕੇ ਮੇਰੇ ਨਾਲ ਜਿਹੜੇ ਮੁੰਡੇ ਹੈਗੇ ਹੈ ਇਨ੍ਹਾਂ ਨੂੰ ਵੀ ਆਰਮੀ ਦਾ ਬਹੁਤ ਸ਼ੌਂਕ ਹੈਗਾ ਅਤੇ ਅਸੀਂ ਰੋਜ਼ ਸਵੇਰੇ ਜਿਹੜੇ ਹੈਗੇ ਹੈ ਅਸੀਂ ਦੌੜ ਲਗਾਉਣ ਜਾਂਦੇ ਹਾਂ ਅਤੇ ਦੌੜ ਲਗਾਉਣ ਤੋਂ ਪਹਿਲਾਂ ਜਿਹੜੀ ਐਕਸਰਸਾਈਜ ਕਰਦੇ ਹਾਂ ਅੱਧਾ ਘੰਟਾ ਅਸੀਂ ਐਕਸਰਸਾਈਜ ਕਰਦੇ ਰਹਿੰਦੇ ਹਾਂ ਅਤੇ ਉਹਦੇ ਤੋਂ ਬਾਅਦ ਦੌੜ ਲਾ ਕੇ ਅਤੇ ਜਿਹੜੀ ਅਸੀਂ ਪੰਜ ਜਾਂ ਛੇ ਕਿਲੋਮੀਟਰ ਦੌੜ ਲਾ ਲਾਨੇ ਹਾਂ ਅਤੇ ਓਹਦੇ ਤੋਂ ਬਾਅਦ ਫੇਰ ਅਸੀਂ ਘੰਟਾ ਅੱਧਾ ਘੰਟਾ ਫੇਰ ਐਕਸਰਸਾਈਜ ਕਰਦੇ ਹਾਂ ਓਹਦੇ ਤੋਂ ਬਾਅਦ ਅਸੀਂ ਘਰ ਆ ਘਰ ਆ ਕੇ ਫੇਰ ਅਸੀਂ ਫਰੈਸ਼ ਹੋ ਜਾਂਦੇ ਹਾਂ ਅਤੇ ਸ਼ਾਮੀ ਫਿਰ ਅਸੀਂ ਫਿਰ ਦੌੜ ਲਾਨੇ ਹਾਂ ਅਤੇ ਜਿਹੜਾ ਤੁਹਾਨੂੰ ਮੈਂ ਇੱਦਾਂ ਹੀ ਗੱਲ ਕਰਾਂ ਕਿ ਪਠਾਨਕੋਟ ਵਿੱਚ ਇੱਕ ਅਕੈਡਮੀ ਹੈਗੀ ਹੈ ਮੈਂ ਓਹਦੇ ਨਾਲ ਵੀ ਸੰਬੰਧ ਰੱਖਦਾ ਅਤੇ ਹਫ਼ਤੇ ਜਾਂ ਦੋ ਹਫ਼ਤੇ ਦੋ ਹਫ਼ਤੇ ਵਿੱਚ ਦੋ ਵਾਰੀ ਮੈਂ ਜਿਵੇਂ ਉੱਧਰ ਵੀ ਦੌੜ ਲਾਣ ਜਾਂਦਾ ਅਤੇ ਜਿਹੜਾ ਕਿ ਦੌੜ ਲਾਉਣ ਦੇ ਸਾਨੂੰ ਫਾਇਦੇ ਹੈ ਜਿਹੜੇ ਦੌੜ ਲਾਉਣ ਦੇ ਫਾਇਦੇ ਬਹੁਤ ਬੜੇ ਹੁੰਦੇ ਹੈ ਸਾਹ ਦੀ ਪ੍ਰੋਬਲਮ ਨਹੀਂ ਹੁੰਦੀ ਬੰਦਾ ਜਿਹੜਾ ਫਿੱਟ ਫਿੱਟਨੈੱਸ ਜਿਹੜੀ ਹੁੰਦੀ ਹੈ ਉਹ ਬਣੀ ਰਹਿੰਦੀ ਹੈ ਤਾਂ ਕਰਕੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਾਰਿਆਂ ਨੂੰ ਦੌੜ ਲਗਾਉਣੀ ਚਾਹੀਦੀ ਹੈ ਅਤੇ ਕਮ ਸੇ ਕਮ ਦਿਨ ਵਿੱਚ ਪੰਜ ਛੇ ਕਿਲੋਮੀਟਰ ਦੌੜ ਲਗਾਉਣੀ ਚਾਹੀਦੀ ਹੈ